ਹੈਲੋ ਮੈਂ ਗੁਰਲੀਨ ਕੌਰ ਕੀ ਮੈਂ ਊਬਰ 'ਤੇ ਗੱਲ ਕਰਨੀ ਆ ਮੈਂ ਕਹਿਣਾ ਸੀ ਕਿ ਮੈਂ ਕੱਲ੍ਹ ਇੱਕ ਕੈਬ ਬੁੱਕ ਕੀਤੀ ਸੀ ਅੱਜ ਵਾਸਤੇ ਅੱਜ ਮੈਂ ਗੁਰਦਾਸਪੁਰ ਜਾਣਾ ਸੀ ਇਸ ਲਈ ਮੈਂ ਕੱਲ੍ਹ ਹੀ ਐਡਵਾਂਸ ਦੇ ਵਿੱਚ ਆਪਣੀ ਕੈਬ ਬੁੱਕ ਕਰ ਲਈ ਤਾਂ ਕਿ ਮੈਨੂੰ ਅੱਜ ਕੋਈ ਪ੍ਰੋਬਲਮ ਨਾ ਹੋਵੇ ਅਤੇ ਟਾਈਮ 'ਤੇ ਕੈਬ ਆ ਜੇ ਮੇਰੀ ਕੈਬ ਦੀ ਟਾਈਮਿੰਗ ਸੀਗੀ ਦਸ ਵਜੇ ਦੀ ਅਤੇ ਹੁਣ ਸਾਢੇ ਦਸ ਹੋ ਚੁੱਕੇ ਨੇ ਬਟ ਹਜੇ ਤੱਕ ਕੋਈ ਮੇਰੇ ਕੋਲ ਕੈਬ ਆਈ ਨਹੀਂ ਹੈਗੀ ਇਸ ਲਈ ਮੈਂ ਓਹ ਜਾਣਨ ਲਈ ਫੋਨ ਕੀਤਾ ਸੀਗਾ ਕਿ ਕੈਬ ਜਿਹੜੀ ਹੁਣ ਕਿੱਥੇ ਹੈ ਅਤੇ ਮੇਰੇ ਤੱਕ ਕਦੋਂ ਤੱਕ ਪਹੁੰਚੇਗੀ ਤਾਂ ਜੋ ਮੈਂ ਲੇਟ ਨਾ ਹੋਵਾਂ ਜਿਹੜਾ ਮੇਰਾ ਫੈਮਲੀ ਫੰਕਸ਼ਨ ਆ ਗੁਰਦਾਸਪੁਰ ਉਹ ਬਹੁਤ ਹੀ ਜ਼ਿਆਦਾ ਇੰਮਪੋਰਟੈਂਟ ਆ ਮੇਰੇ ਲਈ ਮੇਰੇ ਸਾਰੇ ਰਿਸ਼ਤੇਦਾਰਾਂ ਦੇ ਮੈਨੂੰ ਬਾਰ ਬਾਰ ਫੋਨ ਆ ਰਹੇ ਨੇ ਕਿ ਮੈਂ ਕਦੋਂ ਤੱਕ ਪਹੁੰਚੇਗੀ ਕਿਉਂਕਿ ਮੈਂ ਇਹ ਫ ਫੈਮਲੀ ਫੰਕਸ਼ਨ ਆਪਣਾ ਮਿਸ ਨਹੀਂ ਕਰ ਸਕਦੀ ਬਹੁਤ ਹੀ ਜ਼ਿਆਦਾ ਇੰਮਪੋਰਟੈਂਟ ਆ ਜੇ ਮੈਂ ਫੈਮਲੀ ਫੰਕਸ਼ਨ ਮਿਸ ਕਰਤਾ ਅਤੇ ਮੈਨੂੰ ਬਹੁਤ ਲੋਸ ਹੋਵੇਗਾ ਇਸ ਲਈ ਮੈਨੂੰ ਇਹ ਜਾਣਕਾਰੀ ਹੁਣੇ ਚਾਹੀਦੀ ਆ ਕਿ ਜਿਹੜੀ ਕੈਬ ਆ ਉਹ ਮੇਰੇ ਤੱਕ ਕਦੋਂ ਪਹੁੰਚੇਗੀ ਅਤੇ ਹੁਣ ਇਸ ਵਕਤ ਕਿੱਥੇ ਆ ਅਤੇ ਇਹ ਕੈਬ ਮੈਂ ਪਹਿਲਾਂ ਵੀ ਇੱਕ ਵਾਰੀ ਬੁੱਕ ਕੀਤੀ ਸੀਗੀ ਬਟ ਉਦੋਂ ਵੀ ਸੇਮ ਸਿਚੁਏਸ਼ਨ ਆਈ ਹੀਗੀ ਕੈਬ ਲੇਟ ਆਈ ਸੀ ਬਟ ਮੈਂ ਇਸ ਵਾਰੀ ਫਿਰ ਸੋਚਿਆ ਚਲੋ ਫਿਰ ਇੱਕ ਵਾਰ ਕੋਈ ਗੱਲ ਨਹੀਂ ਆਪਾਂ ਟਰਾਈ ਕਰਦੇ ਹਾਂ ਸ਼ਾਇਦ ਇਸ ਵਾਰ ਟਾਈਮ 'ਤੇ ਆ ਜੇ ਬਟ ਹਜੇ ਤੱਕ ਵੀ ਨਹੀਂ ਪਹੁੰਚੀ ਸੋ ਪਲੀਜ਼ ਮੈਨੂੰ ਇਨਫੋਰਮ ਕਰੋ ਕਿ ਕਦੋਂ ਤੱਕ ਮੇਰੇ ਹੁਣ ਕੈਬ ਪਹੁੰਚੇਗੀ ਮੇਰੇ ਤੱਕ ਤਾਂ ਜੋ ਮੈਂ ਗੁਰਦਾਸਪੁਰ ਟਾਈਮ 'ਤੇ ਜਾ ਸਕਾਂ ਅਤੇ ਆਪਣਾ ਫੈਮਿਲੀ ਫੰਕਸ਼ਨ ਜਿਹੜਾ ਵਾ ਉਹ ਅਟੈਂਡ ਕਰ ਸਕਾਂ ਥੈਂਕ ਯੂ